ਜੋ ਪੇਂਡੂ ਖੇਤਰ ਵਿੱਚ ਪਿੰਡ ਦੇ ਨੌਜਵਾਨ ਇਕੱਠੇ ਹੋ ਕੇ ਗਰਾਊਂਡ ਵਿੱਚ ਖੇਡਦੇ ਹਨ ਜਿਹਦੇ ਕਰਕੇ ਉਹ ਰੋਜ਼ ਆਉਂਦੇ ਹਨ ਆਪਸ 'ਚ ਮਿਲਦੇ ਹਨ ਗੱਲਾਂ ਬਾਤਾਂ ਕਰਦੇ ਹਾਂ ਅਤੇ ਆਪਸ ਵਿੱਚ ਦੁੱਖ ਸੁੱਖ ਸਾਂਝੇ ਕਰਦੇ ਹਨ ਜਿਹਦੇ ਕਰਕੇ ਆਪਸੀ ਭਾਈਚਾਰਾ ਕਾਫੀ ਵੱਡੇ ਪੱਧਰ 'ਤੇ ਫੈਲਦਾ ਹੈ ਜਦੋਂ ਇਕੱਠੇ ਹੋ ਕੇ ਪਿੰਡਾਂ ਵਿੱਚ ਪੇਂਡੂ ਮੇਲੇ ਪੇਂਡੂ ਖੇਡਾਂ ਕਰਵਾਉਂਦੇ ਹਨ ਤਾਂ ਬਾਹਰੀ ਲੋਕ ਵੀ ਆ ਕੇ ਦੇਖਦੇ ਹਨ ਕਿ ਇਸ ਪਿੰਡ ਦਾ ਕਿੰਨਾ ਹੀ ਵਧੀਆ ਜੋ ਭਾਈਚਾਰਾ ਆਪਸ ਵਿੱਚ ਭਾਈਚਾਰਕ ਸਾਂਝ ਪਿੰਡ ਵਾਲਿਆਂ ਦੀ ਆਪਸ ਵਿੱਚ ਬਣਦੀ ਹੈ ਜਿਹਦੇ ਕਰਕੇ ਹੋਰਨਾਂ ਲੋਕਾਂ ਨੂੰ ਵੀ ਇਸ ਗੱਲ ਤੋਂ ਪ੍ਰੇਰਨਾ ਮਿਲਦੀ ਹੈ ਅਤੇ ਉਹ ਖੁਦ ਵੀ ਪਿੰਡ ਵਿੱਚ ਇਕੱਠੇ ਹੋ ਕੇ ਪੇਂਡੂ ਖੇਡ ਜਾਂ ਖੇਤਰ ਪੇਂਡੂ ਖੇਡਾਂ ਕਰਵਾਉਂਦੇ ਹਨ ਆਪਸ ਵਿੱਚ ਭਾਈਚਾਰਕ ਸਾਂਝ ਵਧਾਉਣ ਦਾ ਇੱਕ ਵਧੀਆ ਉਪਰਾਲਾ ਹੈ ਕਿ ਆਪਾਂ ਖੇਡਾਂ ਖੇਡੀਏ ਇੱਕਠੇ ਹੋ ਕੇ ਵੱਧ ਤੋਂ ਵੱਧ ਗਰਾਊਡਾਂ ਨੂੰ ਜਾਈਏ ਤਾਂ ਜੋ ਸਾਡੀ ਆਪਸੀ ਭਾਈਚਾਰਕ ਸਾਂਝ ਵੱਧਦੀ